ਪਾਣੀ ਨੂੰ ਸ਼ੁੱਧ ਕਰਨ ਲਈ ਹੁਣ ਤਾਂ ਕਾਫ਼ੀ ਤਰੀਕੇ ਆ ਗਏ ਹਨ ਜਿਵੇਂ ਕਿ ਫਿਲਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਪ੍ਰੰਤੂ ਪੁਰਾਣੇ ਸਮੇਂ ਵਿੱਚ ਕੋਲੇ ਅਤੇ ਮਿੱਟੀ ਦੀ ਸਹਾਇਤਾ ਨਾਲ ਵੀ ਪਾਣੀ ਨੂੰ ਸ਼ੁੱਧ ਕੀਤਾ ਜਾਂਦਾ ਸੀ ਅਤੇ ਇਸ ਤੋਂ ਇਲਾਵਾ ਪਾਣੀ ਨੂੰ ਅੱਗ ਉੱਤੇ ਵੀ ਸ਼ੁੱਧ ਕਰ ਦਿੱਤਾ ਜਾਂਦਾ ਸੀ ਕਿਉਂਕਿ ਸ਼ੁੱ ਪਾਣੀ ਨੂੰ ਗਰਮ ਕਰਨ ਦੇ ਨਾਲ ਉਸ ਅੰਦਰਲੇ ਕੀਟ ਮਰ ਜਾਂਦੇ ਸਨ ਅਤੇ ਉਹ ਪੀਣ ਦੇ ਯੋਗ ਹੋ ਜਾਂਦਾ ਸੀ ਅਤੇ ਜੇਕਰ ਘਰੇਲੂ ਇਲਾਜ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਪਾਣੀ ਨੂੰ ਸ਼ੁੱਧ ਕਰਨ ਲਈ ਅਸੀਂ ਫਟਕੜੀ ਦੀ ਸਹਾਇਤਾ ਲੈ ਸਕਦੇ ਹਾਂ ਫਟਕੜੀ ਦਾ ਛੋਟਾ ਜਿਹਾ ਟੁੱਕੜਾ ਬਿਲਕੁਲ ਦਾਣੇ ਦੇ ਬਰਾਬਰ ਲੈ ਕੇ ਅਸੀਂ ਪਾਣੀ ਵਿੱਚ ਪਾ ਸਕਦੇ ਹਾਂ ਅਤੇ ਉਸ ਨਾਲ ਪਾਣੀ ਸ਼ੁੱਧ ਹੋ ਜਾਂਦਾ ਅਤੇ ਅਸ਼ੁੱਧੀਆਂ ਥੱਲੇ ਆ ਜਾਂਦੀਆਂ ਹਨ